ਦੋ ਜੁਲਾਈ ਉੱਨੀ ਸੌ ਅਠਾਨਵੇਂ ਇੱਕ ਅਗਸਤ ਦੋ ਹਜ਼ਾਰ ਪੰਦਰਾਂ ਵੀਹ ਸਤੰਬਰ ਦੋ ਹਜ਼ਾਰ ਸੱਤ ਨੌਂ ਅਕਤੂਬਰ ਦੋ ਹਜ਼ਾਰ ਪੰਦਰਾਂ ਅਠਾਰਾਂ ਦਸੰਬਰ ਦੋ ਹਜ਼ਾਰ ਚੌਵੀ